ਇੱਕ ਅਗਸਤ ਉੱਨੀ ਸੌ ਛਿਆਨਵੇਂ ਪੰਜ ਦਸੰਬਰ ਦੋ ਹਜ਼ਾਰ ਤਿੰਨ ਵੀਹ ਜੁਲਾਈ ਦੋ ਹਜ਼ਾਰ ਪੰਜ ਦਸ ਅਕਤੂਬਰ ਦੋ ਹਜ਼ਾਰ ਅੱਠ ਨੌ ਜਨਵਰੀ ਦੋ ਹਜ਼ਾਰ ਦਸ